ਭੰਗੜੇ ਦੇ ਕੁਛ ਆਮ ਸਟੈਪ ਕੀ ਹਨ ਅਤੇ ਉਹ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ ਭੰਗੜੇ ਦੇ ਕੁਛ ਸਟੈਪ ਆਮ ਸਟੈਪ ਇਹ ਹਨ ਕਿ ਅਸੀਂ ਬਾਹਾਂ ਲੱਤਾਂ ਖੋ ਖੋਲ ਕੇ ਨੱਚਦੇ ਹਾਂ ਅਤੇ ਇੰਜੋਏ ਕਰਦੇ ਹਾਂ ਅਤੇ ਇਹ ਸਾਡੇ ਸੱਭਿਆਚਾਰ ਦੇ ਦਾ ਸੂਚਕ ਹੈ ਅਤੇ ਅਸੀਂ ਹਰ ਮੇਲੇ ਤਿਉਹਾਰ 'ਤੇ ਇਸ ਨੂੰ ਮਤਲਬ ਕਿ ਅਸੀਂ ਨੱਚਦੇ ਹਾਂ ਅਤੇ ਇੰਜੋਏ ਕਰਦੇ ਹਾਂ ਸਾਡੇ ਸੱਭਿਆਚਾਰਕ ਵਿਸਾਖੀ ਦਾ ਮੇਲਾ ਲੋਹੜੀ ਦਾ ਜਾਂ ਸਾਡੇ ਕਈ ਵਿਆਹ ਸ਼ਾਦੀ ਹੁੰਦਾ ਹੈ ਉਹਦੇ ਵਿੱਚ ਜਿੰਨਾ ਚਿਰ ਅਸੀਂ ਭੰਗੜਾ ਨਹੀਂ ਪਾਉਂਦੇ ਤਾਂ ਕੋਈ ਵੀ ਸਾਡਾ ਜਸ਼ਨ ਪੂਰਾ ਨਹੀਂ ਹੁੰਦਾ ਹੈ ਖੁਸ਼ੀ ਦਾ ਮਾਹੌਲ ਇਹਦੇ ਨਾਲ ਹੀ ਸਾਡੇ ਘਰਾਂ 'ਚ ਬਣਦਾ ਹੈ ਅਤੇ ਇਸ ਲਈ ਅਸੀਂ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਸਾਡੇ ਸੱਭਿਆਚਾਰਕ ਦਾ ਮਤਲਬ ਕਿ ਖ਼ਾਸ ਮੰਨਿਆ ਹੋਇਆ ਹੈ ਅਤੇ ਇਸ ਕਰਕੇ ਅਸੀਂ ਭੰਗੜਾ ਦੇ ਨਾਲ ਪੰਜਾਬੀ ਸੱਭਿਆਚਾਰਕ ਵਿੱਚ ਸਾਡੇ ਪੰਜਾਬੀ ਬਹੁਤ ਇੰਜੋਏ ਕਰਦੇ ਹਨ